ਹੈਲੋ ਹਾਂਜੀ ਗੁਰਜੀਤ ਸਿੰਘ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਵਾ ਵਧੀਆ ਵਧੀਆ ਜੀ ਤੁਸੀਂ ਸੁਣਾਉ ਠੀਕ ਠਾਕ ਹੋਰ ਫਿਰ ਬੱਚੇ ਕਿੱਧਰ ਪੜ੍ਹਦੇ ਨੇ ਅੱਜ ਕੱਲ੍ਹ ਅੱਛਾ ਠੀਕ ਠੀਕ ਆ ਠੀਕ ਆ ਹਾ ਫਤਿਹਗੜ੍ਹ 'ਚ ਸਕੂਲ ਵਧੀਆ ਸਕੂਲ ਨੇ ਮੈਨੂੰ ਲੱਗਦੀ ਆ ਇਹ ਆਪਣੇ ਉੱਥੇ ਹੀ ਬਸ ਪੜ੍ਹਦੇ ਨੇ ਜੀ ਗੋਬਿੰਦਗੜ੍ਹ ਹਾਂ ਸਕੂਲ ਤਾਂ ਪਹਿਲਾਂ ਤਾਂ ਵਧੀਆ ਸੀ ਜੀ ਉੱਥੇ ਜਦੋਂ ਪੀ ਕੇ ਅਰੋੜਾ ਪ੍ਰਿੰਸੀਪਲ ਹੁੰਦੇ ਸੀ ਉੱਥੇ ਬੜਾ ਵਧੀਆ ਨਾਂ ਸੀ ਬੜਾ ਵਧੀਆ ਪੜ੍ਹਾਈ ਸੀ ਸਾਰਾ ਕੁਛ ਪਰ ਜਦੋਂ ਉਹਨਾਂ ਨੇ ਚੇਂਜ ਕਰਤੇ ਪ੍ਰਿੰਸੀਪਲ ਸਾਹਿਬ ਇੱਕ ਮੈਡਮ ਕੋਈ ਪ੍ਰਿੰਸੀਪਲ ਆਈ ਆ ਪਰ ਹੁਣ ਉਹ ਸਟੈਂਡਰਡ ਨਹੀਂ ਰਿਹਾ ਸਕੂਲ ਦਾ ਐਡਾ ਵਧੀਆ ਮੈਨੂੰ ਲੱਗਦਾ ਪੜ੍ਹਾਈ ਓ ਹੁਣ ਉੱਥੇ ਐਨੀ ਨਾ ਇਹਦੇ ਨਾਲੋਂ ਤਾਂ ਤੁਹਾਡੇ ਜਿਹੜਾ ਤੁਸੀਂ ਦੱਸਦੇ ਜੀਸਸ ਅਤੇ ਡਿਵਾਈਨ ਲਾਈਟ ਵਧੀਆ ਸਕੂਲ ਨੇ ਮੈਨੂੰ ਲੱਗਦੀ ਆ ਇਹ ਇਥੇ ਕਿਵੇਂ ਆ ਜੀ ਉਹ ਬੱਚੇ ਪਤਾ ਲੱਗਦਾ ਹੋਣਾ ਤੈਨੂੰ ਕਿਵੇਂ ਪੜ੍ਹਦੇ ਨੇ ਬੱਚੇ ਠੀਕ ਹੈ ਹਾਂਜੀ ਸਿਸਟਮ ਮੈਨੂੰ ਪਤਾ ਲੱਗਿਆ ਜੀ ਕੇਰਲਾ ਦਾ ਸਟਾਫ ਆ ਅਤੇ ਵਧੀਆ ਮਿਹਨਤ ਕਰਵਾਉਂਦੇ ਨੇ ਕਹਿੰਦੇ ਕਾਫੀ ਜ਼ਿਆਦਾ

ਹਮ ਠੀਕ ਆ ਠੀਕ ਆ ਅਤੇ ਡਿਵਾਇਨ ਲਾਈਟ ਕਿਹਨਾਂ ਦਾ ਸਕੂਲ ਆ ਡਿਵਾਈਨ ਲਾਈਟ ਆਪਣਾ ਲੋਕਲ ਹੈ ਜੀ ਸਕੂਲ ਇਹ

ਓਕੇ ਓਕੇ ਓਕੇ ਉਹਨਾਂ ਦਾ ਠੀਕ ਆ ਠੀਕ ਆ ਠੀਕ ਠੀਕ ਆ ਠੀਕ ਆ ਹਾਂ ਐਜੂਕੇਸ਼ਨ ਤੋਂ ਆਏ ਸੀ ਨਾ ਫਿਰ ਉੱਧਰ ਫਿਰ ਉਹਨਾਂ ਨੇ ਉਹ ਕਰਿਆ ਹਾਂ ਮਤਲਬ ਹੁਣ ਤਾਂ ਫਿਰ ਜੇ ਸਰਹਿੰਦ 'ਚ ਦੇਖਿਆ ਜਾਵੇ ਆਪਣੇ ਇਹੀ ਜੀਸਸ ਡਿਵਾਇਨ ਲਾਈਟ ਵਧੀਆ ਜ਼ਿਆਦਾ ਸਕੂਲ ਮੰਨੇ ਜਾਂਦੇ ਹੈ ਨਾ ਅੱਛਾ ਫੀਸਾਂ ਵੀ ਹਾਂ ਦੀ ਫੀਸ ਜ਼ਿਆਦਾ ਥੋੜ੍ਹੀ ਜਿਹੀ ਜ਼ਿਆਦਾ ਉਹਨਾਂ ਨਾਲੋਂ ਤਾਂ ਹੁਣ ਉਹ ਸਟੈਂਡਡ ਹੈ ਨਹੀਂ ਐਨਾ ਮਤਲਬ ਕਿ ਫੀਸ ਥੋੜ੍ਹੀ ਜਿਹੀ ਜ਼ਿਆਦਾ ਉਹਨਾਂ ਦੀ ਬਾਕੀ ਚਲੋ ਫਿਰ ਠੀਕ ਆ ਆਪਾਂ ਹੁਣ ਫਿਰ ਮਿਲਕੇ ਗੱਲ ਕਰਦੇ ਆ ਠੀਕ ਆ ਜੀ ਠੀਕ ਆ ਜੀ